ਭਾਰਤ ਵੇਿੱਚ ਬਹੁਤ ਜ਼ਿਆਦਾ ਮਸ਼ਹੂਰ ਨਾਚ ਸ਼ੈਲੀਆਂ ਪਾਈਆਂ ਜਾਂਦੀਆਂ ਹਨ ਬਹੁਤ ਜ਼ਿਆਦਾ ਪੰਜਾਬ 'ਚ ਨਾਚ ਸ਼ੈਲੀਆਂ ਦੇ ਰੂਪ ਜਿਵੇਂ ਕਿ ਗਿੱਧਾ ਭੰਗੜਾ ਕੱਥਕ ਗਰਵਾ ਇਸੇ ਤਰ੍ਹਾਂ ਭਾਰਤ ਵਿੱਚ ਮਸ਼ਹੂਰ ਡਾਂਸਰ ਕਾਫੀ ਜ਼ਿਆਦਾ ਹਨ ਬਹੁਤ ਵਧੀਆ ਵਧੀਆ ਡਾਂਸਰ ਪੰਜਾਬ ਵਿੱਚ ਇੰਡੀਆ 'ਚ ਸਾਡੇ ਭਾਰਤ ਵਿੱਚ ਪਾਏ ਜਾਂਦੇ ਹਨ ਇਸ ਜਿਸਦਾ ਜਿਹਨਾਂ ਵਿੱਚੋਂ ਪੰਜਾਬ ਦੇ ਪੰਮੀ ਬਾਈ ਜੋ ਕਿ ਭੰਗੜੇ ਨੂੰ ਇੱਕ ਨਵਾਂ ਰੂਪ ਦੇ ਕੇ ਉੱਭਰੇ ਹਨ ਔਰ ਬਹੁਤ ਸੋਹਣਾ ਭੰਗੜਾ ਸਿਖਾਉਂਦੇ ਹਨ